ਮੈਂ ਆਕਾਸ਼ ਇਲੈਕਟ੍ਰੋਨਿਕਸ ਤੋਂ ਪਹਿਲੀ ਵਾਰ ਇੱਕ ਪੱਖਾ ਲੈ ਕੇ ਆਈ ਸੀ ਪੱਖੇ ਦੀ ਵਰਤੋਂ ਕਰਨ ਤੋਂ ਬਾਅਦ ਮੈਨੂੰ ਇਹ ਬਹੁਤ ਵਧੀਆ ਲੱਗਾ ਨਾ ਤਾਂ ਇਸ ਦੇ ਚੱਲਦੇ ਹੋਏ ਦੀ ਜ਼ਿਆਦਾ ਆਵਾਜ਼ ਆਉਂਦੀ ਹੈ ਅਤੇ ਇਸ ਦੀ ਬਿਜਲੀ ਦੀ ਖਪਤ ਵੀ ਨਾ ਮਾਤਰ ਹੀ ਹੈ ਸਾਡੇ ਤਿੰਨ ਮੰਜਿਆਂ ਨੂੰ ਹਵਾ ਵੀ ਆਰਾਮ ਨਾਲ ਆ ਜਾਂਦੀ ਹੈ ਇਸ ਦੀ ਕੀਮਤ ਵੀ ਹੋਰ ਪੱਖਿਆਂ ਨਾਲ਼ੋਂ ਘੱਟ ਮਿਲ ਗਈ ਸੀ ਇਸ ਪ੍ਰੋਡਕਟ ਦਾ ਅਨੁਭਵ ਮੇਰੇ ਲਈ ਬਹੁਤ ਵਧੀਆ ਰਿਹਾ